ਮੈਂ ਮਾਨਸਾ ਦੀ ਰਹਿਣ ਵਾਲੀ ਹਾਂ ਮੈਂ ਆਪਣੇ ਦੋਸਤ ਦੇ ਕ ਦੱਸੇ ਅਨੁਸਾਰ ਮਾਨਸਾ ਦੀ ਪ੍ਰਸਿੱਧ ਦੁਕਾਨ ਜੱਗਾ ਕਰੋਕਟੀ ਸਟੋਰ ਤੋਂ ਡਸਟਬਿਨ ਲਿਆ ਇਹ ਡਸਟਬਿਨ ਬਲੂ ਕਲਰ ਦਾ ਹੈ ਸਾਡੇ ਘਰ ਵਿੱਚ ਸਾਰਾ ਦਿਨ ਬਹੁਤ ਕੂੜਾ ਹੁੰਦਾ ਜੀ ਜਿਸ ਕਰਕੇ ਮੈਂ ਇਸ ਇਹ ਖਰੀਦਿਆ ਪਰ ਇਸ ਦੀ ਕੁਆਲਿਟੀ ਬਹੁਤ ਚੰਗੀ ਨਹੀਂ ਹੈ ਇਸ ਦਾ ਪਲਾਸਟਿਕ ਵੀ ਵਧੀਆ ਨਹੀਂ ਹੈ ਮੈਂ ਇਸ ਨੂੰ ਪਿਛਲੇ ਹਫ਼ਤੇ ਦੀ ਹੀ ਲੈ ਕੇ ਆਈ ਹਾਂ ਪਰ ਇਹ ਬਹੁਤ ਜਲਦੀ ਟੁੱਟ ਗਿਆ ਇਹ ਡਸਟਬਿਨ ਪੈਰ ਨਾਲ ਖੁੱਲ੍ਹਣ ਵਾਲਾ ਹੈ ਅਸੀਂ ਜਦੋਂ ਇਸ ਨੂੰ ਤਿੰਨ ਚਾਰ ਵਾਰ ਪੈਰ ਨਾਲ ਪ੍ਰੈਸ ਕਰਕੇ ਖੋਲ੍ਹਿਆ ਤਾਂ ਇਹ ਟੁੱਟ ਗਿਆ ਜਦੋਂ ਮੈਂ ਇਸ ਦਾ ਉਲਾਂਭਾ ਸ਼ੋਪ ਵਾਲੇ ਨੂੰ ਦਿੱਤਾ ਤਾਂ ਉਸ ਨੇ ਕੋਈ ਧਿਆਨ ਨਾ ਦਿੱਤਾ ਸਗੋਂ ਮੇਰੀ ਗੱਲ ਅਣਸੁਣੀ ਕਰ ਦਿੱਤੀ ਮੈਂ ਜੋ ਡਸਟਬਿਨ ਲਿਆ ਉਹ ਇਹ ਜਲਦੀ ਭਰ ਜਾਂਦਾ ਹੈ ਅਤੇ ਮੈਨੂੰ ਦਿਨ ਵਿੱਚ ਦੋ ਵਾਰ ਖਾਲੀ ਕਰਨਾ ਪੈਂਦਾ ਹੈ ਜਿਸ ਕਰਕੇ ਮੈਨੂੰ ਪਰੇਸ਼ਾਨੀ ਆਉਂਦੀ ਹੈ ਇਹ ਮਿਲਟਨ ਕੰਪਨੀ ਦਾ ਹੈ ਇਹ ਨਾ ਵਧੀਆ ਓਪਨ ਹੁੰਦਾ ਹੈ ਨਾ ਕਲੋਜ਼ ਹੁੰਦਾ ਹੈ ਮੈਨੂੰ ਹੱਥ ਨਾਲ ਕੂੜਾ ਅੰਦਰ ਕਰਨਾ ਪੈਂਦਾ ਹੈ ਇਸ ਲਈ ਮੈਂ ਤੁਹਾਡੀ ਸ਼ੋਪ ਦਾ ਫੀਡਬੈਕ ਸਭ ਨੂੰ ਮਾੜਾ ਦੇਊਂ ਕਿਉਂਕਿ ਮੈਨੂੰ ਤੁਹਾਡੀ ਦੁਕਾਨ ਦੇ ਸਮਾਨ ਦੀ ਕੁਆਲਿਟੀ ਵਧੀਆ ਨਹੀਂ ਲੱਗੀ ਇਹ ਬਹੁਤ ਬੇਕਾਰ ਸੀ ਮੈਂ ਗੂਗਲ ਤੋਂ ਵੀ ਤੁਹਾਡੀ ਸ਼ੌਪ ਨੂੰ ਫੀਡਬੈਕ ਬੈਸਟ ਨਹੀਂ ਦਿੱਤਾ ਕਿਉਂਕਿ ਮੈਨੂੰ ਇਹ ਬਿਲਕੁਲ ਵਧੀਆ ਨਹੀਂ ਲੱਗਿਆ ਅਤੇ ਮੈਨੂੰ ਇਸ ਕਰਕੇ ਬਹੁਤ ਦਿੱਕਤਾਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ